ਸਾਡਾ ਇਤਿਹਾਸ ਸਾਡਾ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਪੰਜਾਬ ਜਿਹੜਾ ਹੈ ਉਸ ਦਾ ਬੋਡਰ ਕਾਫ਼ੀ ਇਲਾਕਿਆਂ ਨੂੰ ਲੱਗਦਾ ਹੈ ਪੁਰਾਣੇ ਵੇਲੇ ਵਿੱਚ ਵੀ ਰਾਜੇ ਮਹਾਰਾਜੇ ਅਫ਼ਗਾਨੀ ਤੁਰਕੀ ਮੁਸਲਿਮ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਤੇ ਵੀ ਉਹਨਾਂ ਦੇ ਆਉਣ ਦਾ ਰਾਹ ਪੰਜਾਬ ਹੀ ਸੀ ਉਹ ਪੰਜਾਬ ਤੋਂ ਹੀ ਹਿੰਦੁਸਤਾਨ ਵਿੱਚ ਐਂਟਰ ਕਰਦੇ ਸਨ ਤਾਂ ਜੋ ਉਹਨਾਂ ਦੇ ਆਉਣ ਨਾਲ ਪੰਜਾਬ ਦੀ ਭਾਸ਼ਾ ਵੀ ਵੱਖਰੇ ਵੱਖਰੇ ਸਮੇਂ 'ਤੇ ਬਦਲਦੀ ਗਈ ਹੁਣ ਪੰਜਾਬੀ ਮਾਂ ਬੋਲੀ ਵਿੱਚ ਹਿੰਦੀ ਪੰਜਾਬੀ ਤਾਂ ਇੰਗਲਿਸ਼ ਤਿੰਨਾਂ ਦਾ ਮਿਸ਼ਰਣ ਹੈ ਹੁਣ ਪੰਜਾਬ ਵਿੱਚ ਵੈਸੇ ਵੀ ਅਲੱਗ ਅਲੱਗ ਇਲਾਕਿਆਂ ਦੇ ਨਾਲ ਅਲੱਗ ਅਲੱਗ ਭਾਸ਼ਾ ਬੋਲੀ ਜਾਂਦੀ ਹੈ ਜਿਵੇਂ ਕਿ ਪੰਜਾਬ ਦੀਆਂ ਪ੍ਰਸਿੱਧ ਭਾਸ਼ਾਵਾਂ ਹਨ ਮਾਲਵੀ ਮਾਝੀ ਅਤੇ ਦੁਆਬਾ ਵੱਖਰੇ ਵੱਖਰੇ ਖੇਤਰ ਨਾਲ ਜਿਵੇਂ ਬਠਿੰਡੇ ਵਾਲੇ ਪਾਸੇ ਦੁ ਮਾਂ ਮਾਲਵੀ ਚੱਲਦੀ ਹੈ ਇਸ ਤਰ੍ਹਾਂ ਵੱਖਰੇ ਵੱਖਰੇ ਸ਼ਹਿਰਾਂ ਦੀ ਵੱਖਰੀ ਵੱਖਰੀ ਭਾਸ਼ਾ ਹੈ ਮਗਰ ਪੰਜਾਬ ਦੀਆਂ ਤਿੰਨੋਂ ਮੁੱਖ ਬੋਲੀਆਂ ਪੰਜਾਬ ਮਾਲਵਾ ਦੁਆਬੀ ਅਤੇ ਮਾਝੀ ਹੀ ਹੈ ਮਗਰ ਠੇਠ ਪੰਜਾਬੀ ਅੱਜ ਕੱਲ੍ਹ ਸਿਰਫ਼ ਪਿੰਡਾਂ ਵਿੱਚ ਹੀ ਰਹਿ ਗਈ ਹੈ ਸ਼ਹਿਰਾਂ ਵਿੱਚ ਤਾਂ ਪੰਜਾਬੀ ਨੂੰ ਅੰਗਰੇਜ਼ੀ ਤਾਂ ਹਿੰਦੀ ਦੇ ਨਾਲ ਮਿਸ਼ਰਨ ਕਰਕੇ ਬੋਲਿਆ ਜਾਂਦਾ ਹੈ